ਹਾਂਜੀ ਹਾਂਜੀ ਬੋਲੋ ਕੀ ਸੇਵਾ ਕਰ ਸਕਦੇ ਤੁਹਾਡੀ ਹਾਂਜੀ ਹਾਂਜੀ ਆਪਣੀਆਂ ਬੱਸਾਂ ਪੂਰੇ ਪੰਜਾਬ ਵਿੱਚ ਹਰਿਆਣਾ ਜਲੰਧਰ ਲੁਧਿਆਣਾ ਕਪੂਰਥਲਾ ਇਹਨਾਂ ਸਾਰੀਆਂ ਜਿਹੜੀਆਂ ਜਲੰਧਰ ਚੰਡੀਗੜ੍ਹ ਹਰ ਜਗ੍ਹਾ ਪੰਜਾਬ ਦੇ ਮਤਲਬ ਹਰ ਕੋਨੇ ਕੋਨੇ ਵਿਚ ਜਾਂਦੀ ਹੈ ਤੁਸੀਂ ਘੁੰਮਣਾ ਚਾਹੁੰਦੇ ਬੱਸ ਹਾਂਜੀ ਹਾਂਜੀ ਹਾਡੀ ਬੱਸ ਹਮੇਸ਼ਾ ਮਤਲਬ ਜਦੋਂ ਵੀ ਕੋਲਿੰਗ ਕੋਲ ਕਰੋਗੇ ਤਾਂ ਬਸ ਚਲਦੀ ਰਹਿੰਦੀ ਆ ਚੌਵੀ ਘੰਟੇ ਚਲਦੀ ਰਹਿੰਦੀ ਆ ਸਵੇਰੇ ਚੱਲਦੀ ਆ ਸ਼ਾਮਾਂ ਨੂੰ ਦੁਪਹਿਰੇ ਜਦੋਂ ਵੀ ਜਾਣਾ ਚਾਹੋ ਤਾਂ ਵਾਪਸ ਜਾ ਸਕਦੇ ਜੋ ਅਸੀਂ ਤੁਹਾਨੂੰ ਬਹੁਤ ਚੰਗੀ ਤਰਾਂ ਪਹੁੰਚਾਵਾਂਗੇ ਸਾਡੇ ਬੱਸਾਂ ਵਿੱਚ ਬਹੁਤ ਵਧੀਆ ਸੁਵਿਧਾਵਾਂ ਮਿਲਦੀਆਂ ਹੈ ਲੱਗੇ ਆ ਪਰਦੇ ਲੱਗੇ ਆ ਕੋਈ ਘੱਟਾ ਮਿੱਟੀ ਅੰਦਰ ਨਹੀਂ ਜਾਊਗਾ ਤੁਸੀਂ ਜਦੋਂ ਵੀ ਜਾਣ ਚਾਹੋ ਤਾਂ ਜਾ ਸਕਦੇ ਜੇ ਕੋਈ ਦਿੱਕਤ ਨਹੀਂ ਆਉਗੀ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਪੰਜਾਬ ਤੋਂ ਬਾਹਰ ਵੀ ਜਾਂਦੀਆਂ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਸਾਡੀ ਬੱਸ ਵਿੱਚ ਥੈਂਕ ਯੂ ਮੈਡਮ